ਜੀ ਹਾਂ ਸਾਡੇ ਘਰ ਵਿੱਚ ਵੱਖ ਵੱਖ ਪਾਣੀ ਦੇ ਵੱਖ ਵੱਖ ਸਰੋਤ ਹਨ ਜਿਵੇਂ ਕਿ ਨਲਕਾ ਹੋ ਗਿਆ ਖੂਹ ਹੋ ਗਿਆ ਅਤੇ ਟੂਟੀਆਂ ਵਿੱਚੋਂ ਜਿਹੜਾ ਹੁਣ ਪਾਣੀ ਆਉਣ ਲੱਗ ਗਿਆ ਹੈ ਉਹ ਵੀ ਇੱਕ ਪਾਣੀ ਆਉਣ ਦਾ ਸਰੋਤ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਨਲਕਾ ਉਹ ਸਭ ਤੋਂ ਵਧੀਆ ਪਾਣੀ ਦਾ ਸਰੋਤ ਹੈ ਕਿਉਂਕਿ ਉਸ ਨਾਲ ਸਾਡੀ ਕਸਰਤ ਵੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਸਾਹ ਚੜਦਾ ਜਿਸ ਨਾਲ ਸਾਡਾ ਸਰੀਰ ਬਹੁਤ ਤੰਦਰੁਸਤ ਰਹਿੰਦਾ ਹੈ ਅਤੇ ਪਾਣੀ ਵੀ ਧਰਤੀ ਤੋਂ ਆਉਂਦਾ ਹੈ ਜਿਹੜਾ ਸਾਨੂੰ ਬਹੁਤ ਪਵਿੱਤਰ ਲੱਗਦਾ ਹੈ ਇਸ ਨਾਲ ਸਾਨੂੰ ਕੋਈ ਬਿਮਾਰੀ ਵੀ ਨਹੀਂ ਹੁੰਦੀ ਇਸ ਵਿੱਚ ਕੋਈ ਮਿੱਟੀ ਵੀ ਨਹੀਂ ਕੋਈ ਕੀਟਾਣੂ ਵੀ ਨਹੀਂ ਇਹ ਬਹੁਤ ਬਹੁਤ ਪਵਿੱਤਰ ਪਾਣੀ ਹੁੰਦਾ ਹੈ ਇਸ ਨੂੰ ਪੀ ਕੇ ਸਾਨੂੰ ਕੋਈ ਲਗਭਗ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਜਿਸ ਨਾਲ ਸਾਨੂੰ ਡਾਕਟਰਾਂ ਕੋਲ ਵੀ ਜਾਣਾ ਨਹੀਂ ਪੈਂਦਾ ਅਤੇ ਜੇ ਆਪਾਂ ਨਲਕੇ ਦਾ ਪਾਣੀ ਪੀ ਸਕਦੇ ਹਾਂ ਤਾਂ ਸਾਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਇਹ ਇਹ ਸਰੋਤ ਪੂਰੇ ਸਾਲ ਲਈ ਹੁੰਦਾ ਹੈ ਇਸ ਵਿੱਚ ਕੋਈ ਉਹ ਨਹੀਂ ਹੁੰਦਾ ਕਿ ਇਕ ਸਾਲ ਹੀ ਹੋਵੇਗਾ ਜਾਂ ਛੇ ਮਹੀਨੇ ਲਈ ਹੋਵੇਗਾ ਇਹ ਹਮੇਸ਼ਾ ਚਲਦਾ ਹੀ ਰਹਿੰਦਾ ਕਿਉਂਕਿ ਧਰਤੀ ਵਿੱਚੋਂ ਪਾਣੀ ਖਤਮ ਨਹੀਂ ਹੋ ਸਕਦਾ ਇਸ ਲਈ ਮੈਨੂੰ ਇਹ ਸਭ ਤੋਂ ਬਿਹਤਰ ਪਾਣੀ ਦਾ ਸਰੋਤ ਨਲਕਾ ਹੀ ਲੱਗਦਾ ਹੈ